ਗਤਵਾ ਗੱਤਕਾ ਸਾਡੇ ਸ਼੍ਰੀ ਗੁਰੂ ਗੋਬਿੰਦ ਛੇਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਗਿਆ ਹੈ ਗੱਤਕਾ ਪੰਦਰਾਂ ਈਸਵੀ ਤੋਂ ਸ਼ੁਰੂ ਹੋ ਗਿਆ ਸੀ ਅਤੇ ਗੱਤਕਾ ਖੇਡਣ ਲਈ ਕਮੇਟੀਆਂ ਬੜੀਆਂ ਅੱਗੇ ਤੋਂ ਅੱਗੇ ਸਪੋਰਟਸ ਵਾਂਗ ਜਾ ਰਹੀਆਂ ਹਨ ਗੱਤਕਾ ਲੱਕੜ ਦੀ ਲਾਠੀ ਤੋਂ ਆਇਆ ਹੈ ਜੋ ਤਲਵਾਰ ਵਾਂਗ ਨਾਲ ਅ ਕਿ ਅ ਗੁਰੂ ਸਿੱਖ ਖੇਡਦੇ ਹਨ ਅਤੇ ਗੱਤ ਹਉਂ ਗੱਤਕੇ ਨੂੰ ਹੋਲੇ ਮਹੱਲੇ 'ਤੇ ਵੀ ਖੇਡਿਆ ਜਾਂਦਾ ਹੈ ਅਤੇ ਨਗਰ ਕੀਰਤਨ ਵੇਲੇ ਵੀ ਗੱਤਕੇ ਨੂੰ ਬੜੀ ਪਹਿਲ ਦਿੱਤੀ ਜਾਂਦੀ ਹੈ ਅਤੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਗੁਰ ਸਿੱਖ ਹੈ ਜੋ ਰੋਲ ਨਿਭਾਉਂਦੇ ਹਨ ਗੱਤਕਾ ਸਾਡੇ ਗੁਰੂ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਜੋ ਕਿ ਸਾਡੇ ਪਿੰਡ ਵਿੱਚ ਜਦੋਂ ਵੀ ਕੋਈ ਨਗਰ ਕੀਰਤਨ ਵਗੈਰਾ ਕਰਵਾਇਆ ਜਾਂਦਾ ਹੈ ਉਸ ਟਾਈਮ ਗੁਰੂ ਸਿੱਖ ਆਪਣੇ ਅਲੱਗ ਅਲੱਗ ਤਰ੍ਹਾਂ ਰੋਲ ਨਿਭਾਉਂਦੇ ਹਨ ਗੱਤਕਾ ਸਾਡੇ ਛੇਵੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨੂੰ ਅੱਜ ਵੀ ਬਹੁਤ ਚੰਗੇ ਤਰੀਕੇ ਨਾਲ ਜੋ ਸਿੱਖ ਹੈ ਗੁਰੂ ਸਿੱਖ ਹੈ ਬਹੁਤ ਵੀ ਚੰਗੇ ਤਰੀਕੇ ਨਾਲ ਇਸ ਨੂੰ ਨਿਭਾ ਰਹੇ ਨੇ ਹਨ ਅਤੇ ਗੱਤਕਾ ਸਾਡੇ ਹੋਲੇ ਮਹੱਲੇ 'ਤੇ ਨਗਰ ਕੀਰਤਨ ਵੇਲੇ ਕਾਫੀ ਪਿੰਡਾਂ ਵਿੱਚ ਇਸ ਗੁਰਸਿੱਖ ਦੁਆਰਾ ਖੇਡਿਆ ਜਾਂਦਾ ਹੈ